ਮੈਂ ਐਮਜ਼ੋਨ ਤੋਂ ਕੱਲ੍ਹ ਆਪਣਾ ਔਡਰ ਰਿਸੀਵ ਕੀਤਾ ਜਿਸ ਵਿੱਚ ਮੈਨੇ ਦੇਖਿਆ ਕਿ ਮੈਂ ਉਸ ਤੋਂ ਆਪਣਾ ਫ਼ੋਨ ਔਡਰ ਕੀਤਾ ਸੀ ਜਿਸ ਵਿੱਚ ਮੈਂ ਦੇਖਿਆ ਕਿ ਮੇਰਾ ਫ਼ੋਨ ਤਾਂ ਬਿਲਕੁਲ ਹੀ ਖ਼ਰਾਬ ਨਿਕਲਿਆ ਉਸਦੀ ਪੈਕਿੰਗ ਵੀ ਬਹੁਤ ਹੀ ਜ਼ਿਆਦਾ ਗੰਦੀ ਸੀ ਮੈਂ ਰੈਡਮੀ ਦਾ ਫ਼ੋਨ ਔਡਰ ਕੀਤਾ ਸੀ ਪਰ ਮੈਨੂੰ ਰੀਅਲਮੀ ਦਾ ਫ਼ੋਨ ਰਿਸੀਵ ਹੋਇਆ ਜਿਸਦਾ ਕਲਰ ਵੀ ਬਿਲਕੁਲ ਹੀ ਭੱਦਾ ਜਿਹਾ ਸੀ ਇਸਨੂੰ ਦੇਖ ਕੇ ਮੈਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਇਆ ਮੇਰੇ ਘਰੋਂ ਵੀ ਬਹੁਤ ਗਾਲਾਂ ਪਈਆਂ ਕਿਉਂਕਿ ਇਹ ਫ਼ੋਨ ਬਾਜ਼ਾਰ ਵਿੱਚ ਤਾਂ ਦਸ ਹਜ਼ਾਰ ਦਾ ਮਿਲਦਾ ਸੀ ਪਰ ਮੈਂ ਇਹ ਐਮਜ਼ੋਨ ਤੋਂ ਪੰਦਰਾਂ ਹਜ਼ਾਰ ਦਾ ਖਰੀਦਿਆ ਸੀ ਐਮਾਜ਼ੋਨ 'ਤੇ ਮੈਨੂੰ ਬਹੁਤ ਹੀ ਜ਼ਿਆਦਾ ਵਿਸ਼ਵਾਸ ਸੀ ਪਰ ਪਰੰਤੂ ਇਸ ਵਿੱਚ ਇਹ ਦੇਖ ਕੇ ਮੈਨੂੰ ਬੜੀ ਹੀ ਨਿਰਾਸ਼ਾ ਹੋਈ ਮੇਰੇ ਘਰੋਂ ਵੀ ਬਹੁਤ ਹੀ ਜ਼ਿਆਦਾ ਗਾਲਾਂ ਪਈਆਂ ਅਤੇ ਇਸਦਾ ਕਲਰ ਵੀ ਇੰਨਾ ਕੁ ਜ਼ਿਆਦਾ ਗੰਦਾ ਸੀ ਜਿਸਨੂੰ ਕਿ ਹੱਥ ਵਿੱਚ ਫੜਦੇ ਹੋਏ ਵੀ ਬੰਦੇ ਨੂੰ ਸ਼ਰਮ ਆਉਂਦੀ ਸੀ ਇਹ ਬਿਲਕੁਲ ਬੇਕਾਰ ਹੀ ਜ਼ਿਆਦਾ ਕਲਰ ਸੀ ਇਸ ਕਰਕੇ ਮੈਂ ਇਹੀ ਚਾਹਾਂਗੀ ਜਾਂ ਤਾਂ ਮੇਰੇ ਮੈਨੂੰ ਪੈਸੇ ਦੇ ਦਿੱਤੇ ਜਾਣ ਐਮਾਜ਼ੋਨ ਵੱਲੋਂ ਜਾਂ ਤਾਂ ਇਸਨੂੰ ਕੋਈ ਡਿਲੀਵਰੀ ਬੋਆਏ ਆਏ ਅਤੇ ਇਸ ਨੂੰ ਆ ਕੇ ਲੈ ਕੇ ਜਾਵੇ ਕਿਉਂਕਿ ਮੈਂ ਇਸਨੂੰ ਬਿਲਕੁਲ ਵੀ ਰੱਖਣਾ ਨਹੀਂ ਹੈ